ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਆ ਆਪਣਾ ਸੁੱਖਦੀਪ ਕਿਹੜੇ ਘਰਾਂ 'ਚੋਂ ਬੋਲਦਾ ਸਲਾਮਾ ਦੇ ਘਰਾਂ 'ਚੋਂ ਠੀਕ ਹੈ ਦੱਸੋ ਹੁਕਮ ਹਾਂ ਹਾਂ ਆਪਣਾ ਕੰਮ ਆ ਬਾਈ ਵਧੀਆ ਦੇਸੀ ਔਰਗੈਨਿਕ ਬਿਨਾ ਰੇਹ ਸਪਰੇ ਤੋਂ ਤਿਆਰ ਕਰਦੇ ਹਾਂ ਆਪਾਂ ਘਰੇ ਖੇਤੀ ਆਪਣੀ ਹਾਂ ਹਾਂਜੀ ਦੱਸੋ ਹੁਣ ਜਿਵੇਂ ਮੂਹਰੇ ਬੀਜਣੀ ਆ ਹੁਣ ਤਾਂ ਮੂੰਗੀ ਵੱਢ ਕੇ ਹਟੇ ਹਾਂ ਅਸੀਂ ਹਾਂ ਹਾਂ ਹਾਂ ਹਾਂ ਵਧੀਆ ਵਧੀਆ ਪੂਰਾ ਹਾਂ ਬਸ ਇੱਕ ਤਾਂ ਹਾਈਬ੍ਰਿਡ ਬੀਜੀ ਹਾਈਬ੍ਰਿਡ ਹਾਂ ਹਾਈਬ੍ਰਿਡ ਬਸ ਬਾਹਲਾ ਰੇਹ ਨਹੀਂ ਪਾਉਣਾ ਦੂਜਾ ਯੂਰੀਆ ਹਾਂ ਵੱਟਾਂ 'ਤੇ ਲਾ ਦੇ ਵੱਟਾਂ 'ਤੇ ਅੱਛਾ ਪਾਣੀ ਕਿਵੇਂ ਖਾਰਾ ਤਾਂ ਨਹੀਂ ਅੱਛਾ ਅੱਛਾ ਬਸ ਉਹ ਤਾਂ ਤੂੰ ਐਂ ਕਰੀਂ ਵੱਟਾਂ ਬਣਾ ਕੇ ਲਾ ਦੀ ਉਹਦੇ ਉੱਤੇ ਵੱਟਾਂ ਦੇ ਉੱਤੇ ਹਾਂ ਗਮਾਰਾ ਲਾ ਦੀ ਹਾਂ ਕੱਦੂਆਂ ਦੇ ਬੀਜ ਲਾ ਦੀ ਕੱਦੂਆਂ ਵਧੀਆ ਸਬਜ਼ੀ ਹੋ ਜਾਂਦੀ ਕੱਦੂ ਹੋ ਜਾਂਦੇ ਆ ਹੁਣ ਆਪਣੇ ਕੋਲ ਹਾਂ ਹਾਂ ਮਿਲ ਜਾਂਦੇ ਆ ਮਿਲ ਜਾਂਦੇ ਆ ਮੈਂ ਕਹਿੰਦਾ ਪੂਰੇ ਮੈਂ ਵੱਡੇ ਵੱਡੇ ਲਾਏ ਆ ਕੱਦੂ ਪੂਰੇ ਵਧੀਆ ਲੈ ਜਾਓ ਲੈ ਜਾਓ ਕਦੋਂ ਮਰਜ਼ੀ ਕਦੋਂ ਮਰਜ਼ੀ ਹਾਂ ਆ ਜਾਉ ਤੁਸੀਂ ਪਹਿਲਾਂ ਆਪਣੇ ਲੱਗੀਆਂ ਹੋਈਆਂ ਸਬਜ਼ੀਆਂ ਤੁਸੀਂ ਦੇਖਿਓ ਸਬਜ਼ੀਆਂ ਤੁਸੀਂ ਆਹ ਖਾ ਕੇ ਜਮਾ ਐਨ ਖੁਸ਼ ਹੋ ਜਾਓਗੇ ਯਾਰ ਰੂਹ ਖੁਸ਼ ਹੋ ਜਾਂਦੀ ਬੰਦੇ ਦੀ ਪਹਿਲਾਂ ਲਾਉਂਦੇ ਹੋ ਪਹਿਲਾਂ ਸਬਜ਼ੀਆਂ ਲਾਈਆਂ ਤੁਸੀਂ ਅੱਛਾ ਹਾਂ ਹਾਂ ਸਬਜ਼ੀਆਂ ਲਾ ਕੇ ਦੇਖੋ ਤੁਸੀਂ ਨਾਲੇ ਤਾਂ ਪੂਰਾ ਮੁਨਾਫਾ ਪੂਰਾ ਪ੍ਰੋਫਟ ਆ ਇਹਦੇ 'ਚ ਆਪਾਂ ਨੂੰ ਐਵੇਂ ਦੂਜੀਆਂ ਫਸਲਾਂ 'ਚ ਪਈ ਜਾਂਦੇ ਹਾਂ ਬੀਜ ਹਾਂ ਹਾਂ ਦਵਾ ਲਿਆਉਂਗਾ ਉਹ ਤਾਂ ਕੋਈ ਗੱਲ ਨਹੀਂ ਔਰਗੈਨਿਕ ਵਧੀਆ ਬੀਜ ਦਵਾ ਕੇ ਲਿਆਊ ਤੈਨੂੰ ਠੀਕ ਆ ਠੀਕ ਆ ਲੈ ਜਿਉ ਕੋਈ ਗੱਲ ਨਹੀਂ ਅਜਿਓ ਟਾਈਮ ਕੱਢ ਕੇ ਚੌਲੇ ਵੀ ਵਧੀਆ ਹੋ ਜਾਂਦੇ ਹਾਂ ਚੌਲੇ ਚੂਲੇ ਸਭ ਵਧੀਆ ਹਾਂ ਦੇਸੀ ਚੌਲੇ ਗਮਾਰਾ ਰੀਡੀਆਂ ਦੇ ਬੀਜ ਜਿਹੜੇ ਮਰਜ਼ੀ ਵਧੀਆ ਗਰਮੀਆਂ ਵਾਲੀਆਂ ਫਸਲਾਂ ਨੇ ਸਾਰੀਆਂ ਆਪਣੇ ਕੋਲ ਹਾਂ ਹਾਂ ਬੀਜਿਓ ਤੁਸੀਂ ਇਸ ਵਾਰ ਐਤਕੀ ਲਾ ਕੇ ਐਤਕੀ ਦੇਖਿਓ ਵਧੀਆ ਰਿਜਲਟ ਇਹਦਾ ਪੂਰਾ ਆਪਾਂ ਨੂੰ ਪੂਰਾ ਪ੍ਰੋਫਿਟ ਹੈ ਇਹਦੇ 'ਚ ਆਪਾਂ ਨੂੰ ਹਾਂ ਠੀਕ ਹੈ ਠੀਕ ਆ ਠੀਕ ਹੈ ਠੀਕ ਹੈ ਠੀਕ